ਭਾਰਤੀ ਸਮਾਜ ਵਿੱਚ ਧਰਮ ਦੀ ਬਹੁਤ ਭੂਮਿਕਾ ਹੈ ਅਸੀਂ ਪਰ ਹਿੰਦੂ ਧਰਮ ਨੂੰ ਮੰਨਦੇ ਹਾਂ ਪਰ ਅਸੀਂ ਕਿਸੇ ਵੀ ਧਰਮ ਦਾ ਭੇਦਭਾਵ ਨਹੀਂ ਕਰਦੇ ਅਸੀਂ ਸਾਰੇ ਧਰਮਾਂ ਨੂੰ ਇੱਕੋ ਜਿਹਾ ਮੰਨਦੇ ਹਾਂ ਅਸੀਂ ਗੁਰਦੁਆਰੇ ਵੀ ਜਾਂਦੇ ਹਾਂ ਮੰਦਰ ਵੀ ਮਸਜਿਦ ਵੀ ਅਤੇ ਵੀ ਜਾਂਦੇ ਹਾਂ ਸਾਨੂੰ ਸਾਰੇ ਹੀ ਵਧੀਆ ਲੱਗਦੇ ਆ ਕੋਈ ਕਿਸੇ ਤੋਂ ਅਨੇਕਤਾ ਨਹੀਂ ਰੱਖ ਸਕਦਾ ਲੱਗਦਾ ਅਤੇ ਅਸੀਂ ਗੁਰਦੁਆਰੇ ਵਿੱਚ ਲੰਗਰ ਛਕਣ ਵੇਲੇ ਇੱਕੋ ਕਤਾਰ 'ਚ ਬਹਿ ਕੇ ਲੰਗਰ ਛਕਦੇ ਹਾਂ ਅਤੇ ਮੰਦਰਾਂ ਵਿੱਚ ਕੀਰਤਨ ਵਗੈਰਾ 'ਚ ਜਾਂਦੇ ਹਾਂ ਚਰਚ 'ਚ ਵੀ ਜਾਂਦੇ ਹਾਂ ਸਾਨੂੰ ਸਾਰੇ ਹੀ ਧਰਮ ਬਹੁਤ ਹੀ ਵਧੀਆ ਲੱਗਦੇ ਹਨ ਇਹ ਨਹੀਂ ਕਿ ਕੋਈ ਵੀ ਕਿਸੇ ਤੋਂ ਅਲੱਗ ਹੋਵੇ ਕਿਉਂਕਿ ਪਰਮਾਤਮਾ ਇੱਕ ਹੈ ਸਾਰੇ ਹੀ ਉਸਦੇ ਬੰਦੇ ਹਨ ਇਸ ਲਈ ਸਾਨੂੰ ਅਨੇਕਤਾ ਨਹੀਂ ਫੈਲਾਉਣੀ ਚਾਹੀਦੀ ਸਾਨੂੰ ਸਭ ਨੂੰ ਏਕਤਾ ਬਣਾ ਕੇ ਰੱਖਣੀ ਚਾਹੀਦੀ ਹੈ ਤਾਂ ਜੋ ਸਾਡਾ ਸਮਾਜ ਅਲੱਗ ਅਲੱਗ ਨਾ ਹੋਵੇ ਸਾਨੂੰ ਸਾਰੇ ਧਰਮਾਂ ਨੂੰ ਬਰਾਬਰ ਹੀ ਅਧਿਕਾਰ ਦੇਣੇ ਦੇਣੇ ਚਾਹੀਦੇ ਹਨ ਕਿਸੇ ਨੂੰ ਅਲੱਗ ਅਲੱਗ ਨਹੀਂ ਰੱਖਣਾ ਚਾਹੀਦਾ